ਮੈਂ ਫਤਿਹਗੜ੍ਹ ਸਾਹਿਬ ਤੋਂ ਹਾਂ ਮੈਂ ਸਰਕਾਰੀ ਹੋਸਪੀਟਲ ਫਤਿਹਗੜ੍ਹ ਸਾਹਿਬ ਤੋਂ ਸਾਰੇ ਇਲਾਜ ਕਰਾਉਂਦਾ ਹਾਂ ਅਤੇ ਦਵਾਈਆਂ ਦਵੂਈਆਂ ਵੀ ਬਹੁਤ ਵਧੀਆ ਇੱਥੇ ਮਿਲਦੀਆਂ ਹਨ ਡੋਕਟਰ ਵੀ ਬਹੁਤ ਵਧੀਆ ਐਨ ਸਭਾ ਨਾਲ ਵਧੀਆ ਸੁਭਾਅ ਹੈ ਮੈਡਮਾਂ ਦਾ ਡੋਕਟਰ ਮੈਡਮ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੈ ਅਤੇ ਇੱਥੇ ਜਿਵੇਂ ਕਿ ਆਪਾਂ ਲਾਇਨਾਂ ਵਿੱਚ ਲੱਗਦੇ ਹਾਂ ਜੀ ਲਾਇਨਾਂ ਵਿੱਚ ਲੱਗਦੇ ਹਾਂ ਅਤੇ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ ਵੀ ਮਤਲਬ ਸਿੱਧੇ ਬੰਦੇ ਵੀ ਪਰਚੀ 'ਤੇ ਨੰਬਰ ਲਗਾ ਕੇ ਡਾਕਟਰ ਜ਼ਿਆਦਾ ਹੈ ਜੀ ਅਤੇ ਨਾਲ ਦੀ ਨਾਲ ਪੁੱਛ ਲੈਂਦੇ ਹਾਂ ਜਿਵੇਂ ਪਹਿਲਾਂ ਹੁੰਦਾ ਸੀ ਪਹਿਲਾਂ ਬਹੁਤ ਭੀੜ ਹੁੰਦੀ ਸੀ ਪਹਿਲਾਂ ਮਤਲਬ ਗੰਦਗੀ ਹੁੰਦੀ ਸੀ ਜੀ ਪਹਿਲਾਂ ਨਾਲੋਂ ਬਹੁਤ ਵਧੀਆ ਹੋ ਗਿਆ ਚਾਰ ਪੰਜ ਸਾਲ ਪਹਿਲਾਂ ਜੀ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਜਿਵੇਂ ਮੈਂ ਦਵਾਈ ਲੈਂਦਾ ਹੈ ਜੀ ਦਵਾਈਆਂ ਵੀ ਅੰਦਰੋਂ ਅੰਦਰੋਂ ਹੀ ਮਿਲਦੀਆਂ ਮੈਨੂੰ ਬਾਹਰ ਤੋਂ ਨਹੀਂ ਮਿਲਦੀਆਂ ਜਿਵੇਂ ਕੋਈ ਘਰ ਦਾ ਕੋਈ ਮੇਰਾ ਮੈਂਬਰ ਜਿਵੇਂ ਮੈ ਮੇਰੇ ਮੇਰੇ ਘਰ ਦੇ ਹੋ ਗਏ ਜਿਵੇਂ ਡਿਲੀਵਰੀ ਹੋ ਗਈ ਮੈਂ ਆਪਣੇ ਬੱ ਬੱਚੇ ਦੋਵੇਂ ਦੋ ਬੱਚੇ ਹੈ ਜੀ ਮੇਰੇ ਕੋਲ ਮੈਂ ਦੋਵੇਂ ਬੱਚਿਆਂ ਦੀ ਡਿਲੀਵਰੀ ਸਰਕਾਰੀ ਹੋਸਪੀਟਲ 'ਚ ਕਰਾਈ ਆ ਅਤੇ ਮੈਨੂੰ ਪੁੱਛਦੇ ਵੀ ਰਹੇ ਹੈ ਫੋਨ ਕਰਕੇ ਇਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੁੱਛਿਆ ਜੀ ਡਾਕਟਰਾਂ ਨੇ ਮੈਨੂੰ ਫੋਨ ਕਰਕੇ ਵੀ ਪੁੱਛਿਆ ਜੀ ਬਾਹਰੋਂ ਸਰਕਾਰ ਵੱਲੋਂ ਵੀ ਆਪਣਾ ਡਿਲੀਵਰੀ ਕਿੱਦਾਂ ਹੋਈ ਕਿਹੜੇ ਉਨ੍ਹਾਂ ਨੇ ਜਿੱਦਣ ਕੋਈ ਪੁੱਛਦੇ ਹੈ ਟੀਕੇ ਟੂਕੇ ਜੋ ਲੱਗਦਾ ਸਾਰਾ ਫਰੀ ਲਾਉਂਦੇ ਹੈ ਜੀ ਇਹ ਜਿਹੜੇ ਫੋਨ ਕਰਕੇ ਮੈਨੂੰ ਪੁੱਛਦੇ ਹੈ ਜੀ ਮੈਂ ਉਹਨਾਂ ਨੂੰ ਸਹੀ ਦੱਸਦਾ ਵੀ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਮੇਰਾ ਬਾਹਰੋਂ ਇੱਕ ਰੁਪਈਏ ਦਾ ਖਰਚਾ ਨਹੀਂ ਹੋਣ ਦਿੱਤਾ ਜੀ ਇਹਨਾਂ ਨੇ ਅਤੇ ਕੇਸ ਐਨ ਵਧੀਆ ਤਰੀਕੇ ਨਾਲ ਕਰਿਆ ਜੀ ਦੋ ਦਿਨ ਦੋ ਜਾਂ ਤਿੰਨ ਦਿਨ ਸਾਨੂੰ ਹੋਸਪਿਟਲ 'ਚ ਰੱਖਿਆ ਅਤੇ ਰੋਟੀ ਪਾਣੀ ਵੀ ਸਾਰਾ ਖਰ ਇਹਨਾਂ ਦਾ ਹੀ ਹੈ ਜੀ